ਪੰਜਾਬ ਦਿਲਚਸਪ ਇਤਿਹਾਸਿਕ ਜਗ੍ਹਾ ਨਾਲ ਭਰਿਆ ਹੋਇਆ ਹੈ ਇੱਥੋਂ ਦੇ ਸਭ ਤੋਂ ਇੱਕ ਇਤਿਹਾਸਿਕ ਜਗ੍ਹਾ ਹੈ ਜੋ ਕਿ ਸ਼੍ਰੀ ਹਰਿਮੰਦਰ ਸਾਹਿਬ ਹੈ ਜਿੱਥੋਂ ਦਾ ਇਹ ਇਤਿਹਾਸ ਰਿਹਾ ਗਿਆ ਹੈ ਕਿ ਇੱਥੇ ਕਿਸ ਤਰ੍ਹਾਂ ਸਿੱਖਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਇੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਅਤੇ ਸਿੱਖ ਧਰਮ ਦੀ ਨੀਂਹ ਰੱਖੀ ਗਈ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹਨ ਐਸਾ ਹੀ ਇੱਥੇ ਇੱਕ ਸਭ ਤੋਂ ਮਸ਼ਹੂਰ ਜਗ੍ਹਾ ਹੈ ਜਲ੍ਹਿਆਂਵਾਲਾ ਬਾਗ ਜਿੱਥੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇੱਕ ਉਹਨਾਂ ਬੇਗੁਨਾਹਾਂ ਬਜ਼ੁਰਗਾਂ ਔਰਤਾਂ ਅਤੇ ਬੱਚਿਆਂ ਦੇ ਨਿਹੱਥੇ ਬੱਚਿਆਂ ਦੇ ਉੱਤੇ ਜਨਰਲ ਡਾਇਰ ਵੱਲੋਂ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਜਿੰਦਾ ਹੀ ਮਾਰ ਮਾਰ ਦਿੱਤਾ ਗਿਆ ਅੱਜ ਵੀ ਉਥੋਂ ਦੀਆਂ ਕੰਧਾਂ ਚੀਕ ਚੀਕ ਕੇ ਉਸ ਕਿੱਸੇ ਬਾਰੇ ਉਸ ਦਰਦਨਾਕ ਕਿੱਸੇ ਬਾਰੇ ਦੱਸਦੀਆਂ ਹਨ ਅੱਜ ਵੀ ਉਹਨਾਂ ਦੀ ਕੰਧਾਂ ਦੇ ਉੱਤੇ ਉਹ ਬੇਗੁਨਾਹਾਂ ਦੇ ਖੂਨ ਦੇ ਨਿਸ਼ਾਨ ਹਨ ਅੱਜ ਵੀ ਉਹਨਾਂ ਦੇ ਕੰਧਾਂ ਦੇ ਉੱਤੇ ਉਹ ਗੋਲੀਆਂ ਦੇ ਨਿਸ਼ਾਨ ਹਨ ਜਿਨ੍ਹਾਂ ਨਾਲ ਉਹਨਾਂ ਮਾਸੂਮਾਂ ਦੀ ਹੱਤਿਆ ਕੀਤੀ ਗਈ ਉੱਥੇ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਉਸ ਦਿਨ ਹੱਤਿਆ ਕੀਤੀ ਗਈ ਸੀ ਉੱਥੋਂ ਦੇ ਅਜਾਇਬ ਘਰ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਇਤਿਹਾਸ ਕਿੱਥੋਂ ਸ਼ੁਰੂ ਹੋਇਆ ਸੀ ਅਤੇ ਅੱਜ ਕਿੱਥੋਂ ਤੱਕ ਜਾ ਰਿਹਾ ਹੈ ਇਸ ਤਰ੍ਹਾਂ ਹੀ ਇੱਕ ਬਹੁਤ ਮਸ਼ਹੂਰ ਜਗ੍ਹਾ ਜੋ ਅਟਾਰੀ ਵਿੱਚ ਹੈ ਜੋ ਹੈ ਸ਼ਾਮ ਸਿੰਘ ਅਟਾਰੀ ਵਾਲੇ ਦਾ ਅਜਾਇਬ ਘਰ ਉੱਥੋਂ ਸਾਨੂੰ ਸ਼ਾਮ ਸਿੰਘ ਅਟਾਰੀ ਵਾਲੇ ਦੇ ਜੀਵਨ ਬਾਰੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉਸਨੇ ਜੰਗਾਂ ਲੜੀਆਂ ਅਤੇ ਹਰ ਜੰਗ ਦੇ ਵਿੱਚ ਫਤਿਹ ਹਾਸਿਲ ਕੀਤੀ ਅਤੇ ਆਪਣੇ ਦੇਸ਼ ਨੂੰ ਬਚਾਇਆ ਇਸ ਤਰ੍ਹਾਂ ਇੱਥੇ ਇੱਕ ਸਭ ਤੋਂ ਪ੍ਰਸਿੱਧ ਜਗ੍ਹਾ ਵਾਘਾ ਬਾਰਡਰ ਹੀ ਹੈ ਜਿੱਥੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਸੀਮਾ ਰੇਖਾ ਹੈ ਅਤੇ ਸਾਨੂੰ ਉੱਥੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉਹ ਜਗ੍ਹਾ ਆਪਾਂ ਲੜ ਕੇ ਲਈ ਗਈ ਸੀ ਅਤੇ ਉੱਥੋਂ ਦੇ ਜੋ ਆਪਾਂ ਨੂੰ ਪਤਾ ਲੱਗਦਾ ਹੈ ਕਿ ਇੱਥੋਂ ਦੇ ਇਤਿਹਾਸ ਕੀ ਰਿਹਾ ਸੀ ਉੱਥੋਂ ਦੀ ਪਰੇਡ ਬਹੁਤ ਹੀ ਮਸ਼ਹੂਰ ਹੈ ਉੱਥੋਂ ਜਾ ਕੇ ਸਾਨੂੰ ਆਪਣੇ ਦੇਸ਼ ਭਗਤੀ ਦਾ ਜਜ਼ਬਾ ਪਤਾ ਲੱਗਦਾ ਹੈ ਅਤੇ ਇੱਕ ਸਾਨੂੰ ਇੱਕ ਅਲੱਗ ਹੀ ਤਰ੍ਹਾਂ ਦੇ ਸਾਡੇ ਅੰਦਰ ਜਜ਼ਬਾਤ ਉ ਉਖੜਨ ਲੱਗ ਪੈਂਦੇ ਹਨ ਉਹਨਾਂ ਜਗ੍ਹਾ ਉਸ ਜਗ੍ਹਾ 'ਤੇ ਜਾ ਕੇ ਇਸ ਤਰ੍ਹਾਂ ਹੀ ਸਾਡੇ ਜੀ ਇੱਥੇ ਬਹੁਤ ਸਾਰੇ ਜਗ੍ਹਾ ਹਨ ਇਤਿਹਾਸਿਕ ਜਗ੍ਹਾ ਹਨ